ਹਾਂ ਮੈਂ ਸਕੈਚ ਤੋਂ ਪਕਵਾਨ ਬਣਾਇਆ ਇੱਕ ਦਿਨ ਮੇਰੀ ਛੋਟੀ ਜਿਹੀ ਬੇਟੀ ਹੈਗੀ ਹੈ ਉਹਨੇ ਨਾ ਆਪਣਾ ਇੱਕ ਪੇਂਟਿੰਗ ਨਾ ਇੱਕ ਸਕੈਚ ਬਣਾਇਆ ਹੋਇਆ ਸੀ ਬਹੁਤ ਸੋਹਣਾ ਅਤੇ ਮੈਂ ਦੇਖਿਆ ਅਤੇ ਮੇਰੇ ਮਨ 'ਚ ਇੱਕ ਚਾਅ ਉੱਠਿਆ ਕਿ ਮੈਂ ਵੀ ਇਸ ਚੀਜ਼ ਨੂੰ ਰੀਅਲ 'ਚ ਬਣਾਉਣਾ ਹੈ ਅਤੇ ਮੈਂ ਆਪਣੀ ਕਿਚਨ 'ਚ ਗਈ ਸਮਾਨ ਲਿਤਾ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਬੜਾ ਹੀ ਲਵ ਸਿਲਾ ਕੀਤਾ ਸਮਾਨ ਖਰੀਦਿਆ ਕਿ ਮੈਂ ਇਹੋ ਜਿਹੀ ਸੇਮ ਬਣਾ ਕੇ ਦੇਣੀ ਹੈ ਉਹਨੂੰ ਇੱਕ ਖੁਸ਼ ਕਰਨ ਲਈ ਕਿ ਉਹ ਦੇਖੇਗੀ ਕਿ ਜੋ ਮੈਂ ਪਿੰਟਿੰਗ 'ਚ ਬਣਾਇਆ ਮੇਰੀ ਮੰਮਾ ਨੇ ਅਸਲ 'ਚ ਬਣਾ ਕੇ ਮੈਨੂੰ ਦਿੱਤਾ ਅਤੇ ਇਸੇ ਲਈ ਮੈਂ ਬਾਜ਼ਾਰ ਗਈ ਸਮਾਨ ਖਰੀਦਿਆ ਕਾਫੀ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਗਲਤੀ ਵੀ ਹੋਈ ਪਰ ਬਾਅਦ ਵਿੱਚ ਸੇਮ ਟੂ ਸੇਮ ਕੋਪੀ ਉਸੇ ਤਰ੍ਹਾਂ ਦਾ ਪਕਵਾਨ ਮੇਰੇ ਸਾਹਮਣੇ ਬਣਾ ਬਣਿਆ ਮੈਂ ਇੱਕ ਚੀਜ਼ ਦੋ ਚੀਜ਼ ਤਿੰਨ ਚੀਜ਼ ਚਾਰ ਚੀਜ਼ਾਂ ਸਭ ਇਕੱਠੀਆਂ ਕਰਕੇ ਬਹੁਤ ਸੋਹਣਾ ਪਕਵਾਨ ਬਣਾਇਆ ਕਿ ਜਿਹਦੇ ਵਿੱਚ ਮੇਰੀ ਕੁੜੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰੀ ਮੰਮਾ ਨੇ ਇੰਨਾ ਵਧੀਆ ਪਕਵਾਨ ਬਣਾ ਕੇ ਮੇਰੇ ਸਾਹਮਣੇ ਰੱਖ ਦਿੱਤਾ ਜੋ ਕਿ ਮੈਂ ਸੋਚਿਆ ਨਹੀਂ ਸੀ ਕਿਉਂਕਿ ਉਸਨੇ ਤਾਂ ਇੱਕ ਸਕੈਚ ਹੀ ਬਣਾਇਆ ਸੀ ਕਿ ਉਹਨੇ ਇਹ ਸੋਚਿਆ ਨਹੀਂ ਸੀ ਕਿ ਰੀਅਲ ਵਿੱਚ ਵੀ ਇਸ ਤਰ੍ਹਾਂ ਦਾ ਮੇਰੇ ਸਾਹਮਣੇ ਹਾਜ਼ਰ ਹੋ ਸਕਦਾ ਇਹੋ ਜਿਹਾ ਪਕਵਾਨ ਬਸ ਜੇ ਬਣਾਇਆ ਹੈ ਤਾਂ ਬਸ ਉਹਦੀ ਖੁਸ਼ੀ ਲਈ ਬਣਾਇਆ ਹੈ ਕਿ ਜੇ ਮੇਰੇ ਬੱਚੇ ਨੇ ਸੋਚਿਆ ਹੀ ਨਹੀਂ ਕਿ ਮੈਂ ਅਸਲ 'ਚ ਵੀ ਉਹਦੇ ਸਾਹਮਣੇ ਪਕਵਾਨ ਬਣਾ ਕੇ ਰੱਖ ਸਕਦੀ ਹਾਂ ਇਸੇ ਲਈ ਮੈਂ ਖੁਦ ਉਹਦੇ ਸਾਹਮਣੇ ਇਹ ਪਕਵਾਨ ਰੱਖਿਆ ਇੱਕ ਜਿਵੇਂ ਉਹ ਪਕਵਾਨ ਹੈਗਾ ਸੀ ਜਿਵੇਂ ਇੱਕ ਇਡਲੀ ਟਾਈਪ ਹੈਗਾ ਸੀ ਇਡਲੀ ਟਾਈਪ ਉਹਨੇ ਸਕੈਚ ਬਣਾਇਆ ਸੀ ਇਡਲੀ ਟਾਈਪ ਹੀ ਉਹ ਮੈਂ ਸੇਮ ਜੋ ਸਕੈਚ ਵਿੱਚ ਸੀ ਉਹੀ ਸੇਮ ਉਹਦੇ ਸਾਹਮਣੇ ਮੈਂ ਬਣਾ ਕੇ ਰੱਖਿਆ ਤਾਂ ਦੇਖ ਕੇ ਉਹਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਬਹੁਤ ਉਹਨੇ ਮੈਨੂੰ ਕਿਹਾ ਕਿ ਥੈਂਕ ਯੂ ਮੰਮਾ ਕਿ ਤੁਸੀਂ ਮੇਰੇ ਲਈ ਇੰਨਾ ਸੋਹਣਾ ਇੰਨਾ ਵਧੀਆ ਪਕਵਾਨ ਬਣਾਇਆ ਜੋ ਕਿ ਮੈਂ ਸੋਚਿਆ ਨਹੀਂ ਸੀ ਬਸ ਥੈਂਕ ਯੂ